ਜਿਵੇਂ ਕਿਸਾਨ ਦੀ ਜ਼ਮੀਨ ਜਾਇਦਾਦ ਦਾ ਕੋਈ ਵੀ ਵੇਰਵਾ ਹੁੰਦਾ ਹੈ ਤਾਂ ਸਾਨੂੰ ਜਾਂ ਤਾਂ ਪਟਵਾਰੀ ਕੋਲ਼ ਜਾਂ ਵਕੀਲ ਕੋਲ਼ ਜਾਂ ਥਾਣੇ ਪੁਲੀਸ ਥਾਣੇ ਵਿੱਚ ਜਾਂ ਜੱਜ ਕੋਲ਼ ਜਾ ਕੇ ਹੱਲ ਹੁੰਦਾ ਹੈ ਜੇਕਰ ਅਸੀਂ ਇਸਨੂੰ ਔਨਲਾਈਨ ਚੜ੍ਹਾ ਦਿੰਦੇ ਚੜ੍ਹਾਉਂਦੇ ਹਾਂ ਤਾਂ ਅਸੀਂ ਇਸਨੂੰ ਘਰ ਬੈਠ ਕੇ ਵੀ ਦੇਖ ਸਕਦੇ ਹਾਂ ਕਿ ਜ਼ਮੀਨ ਕਿਸ ਦੇ ਨਾਂ ਹੈ ਅਤੇ ਇਹ ਕਿਸ ਦੇ ਨਾਂ ਬੋਲਦੀ ਹੈ ਅਤੇ ਇਸ ਨੂੰ ਔਨਲਾਈਨ ਚੜ੍ਹਾਉਣ ਨਾਲ਼ ਕੋਈ ਵੀ ਦੇਖ ਸਕਦਾ ਹੈ ਕਿ ਇਸ ਦਾ ਮਾਲਕ ਕੌਣ ਹੈ ਇਹਨੂੰ ਔਨ ਚੜ ਔਨਲਾਈਨ ਚੜ੍ਹਾਉਣ ਦਾ ਬਹੁਤ ਫਾਇਦਾ ਹੈ ਇਸੇ 'ਤੇ ਅਸੀਂ ਕਿਸਾਨ ਵੀ ਖੁਦ ਦੇਖ ਸਕਦਾ ਹੈ ਇਹ ਜੱਜ ਕਚਹਿਰੀਆਂ ਵਿੱਚ ਵੀ ਔਨਲਾਈਨ ਚੜ੍ਹਦੀ ਹੈ ਅਤੇ ਹੋਰ ਵੀ ਇਸ ਦਾ ਹੱਲ ਹੋ ਸਕਦਾ ਹੈ